ਬਾਹਰਲੀ ਗਤੀ ਵਿਧੀਆਂ ਉਹ ਹੁੰਦੀਆਂ ਹਨ ਜਿਹੜੇ ਘਰ ਤੋਂ ਬਾਹਰ ਖੇਡੀਆਂ ਜਾਂਦੀਆਂ ਹਨ ਅਤੇ ਖੇਡਾਂ ਹਨ ਜਿਹਨਾਂ ਵਿੱਚ ਸਾਹ ਸਾਹਸ ਦੀ ਲੋੜ ਹੁੰਦੀ ਹੈ ਜਿਵੇਂ ਕਿ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਬੱਚੇ ਫੁੱਟਬਾਲ ਕ੍ਰਿਕਟ ਖੋ ਖੋ ਇਸ ਤਰ੍ਹਾਂ ਖੇਡਦੇ ਹਨ ਕਿ ਜਿਹਨਾਂ ਵਿੱਚ ਜਿਹਨਾਂ ਲਈ ਸਾਹਸ ਵੀ ਲੋੜ ਹੁੰਦੀ ਹੈ ਬ ਬੱਚੇ ਇਸ ਤਰ੍ਹਾਂ ਦੀਆਂ ਖੇਡਾਂ ਤਾਂ ਹੀ ਖੇਡ ਸਕਦੇ ਹਨ ਜੋ ਉਹਨਾਂ ਨੂੰ ਸਾਹਸ ਹੋਵੇ ਤਾਂ ਬੱਚਿਆਂ ਦੇ ਵਿੱਚ ਸਾਹਸ ਤੋਂ ਵੱਧ ਹੋਣ ਨਾਲ ਉਹਨਾਂ ਦੇ ਖੇਡਣ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਉਹ ਖੇਡਾਂ ਜਿੱਤ ਜਾਂਦੇ ਹਨ ਅਤੇ ਸਾਹਸ ਹੋਣ ਨਾਲ ਉਹ ਦੂਰ ਦੂਰ ਤੱਕ ਖੇਡਣ ਜਾਂਦੇ ਹਨ ਅਤੇ ਇਨਾਮ ਲੈ ਕੇ ਆਉਂਦੇ ਹਨ ਖੋ ਖੋ ਖੇਡ ਰਹੇ ਹੋ ਅਤੇ ਉਹਨਾਂ ਨੂੰ ਸ ਭੱਜਣਾ ਪੈਂਦਾ ਹੈ ਅਤੇ ਸਾਹਸ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਆਪਣਾ ਦਿਮਾਗ ਤੇਜ਼ ਰੱਖਣਾ ਪੈਂਦਾ ਹੈ ਅਤੇ ਸਟਰੋਂਗ ਬਣਨਾ ਪੈਂਦਾ ਹੈ ਫੁਟਬਾਲ ਵਰਗੀਆਂ ਖੇਡਾਂ ਵੀ ਵਿੱਚ ਸਾਹਸ ਦੀ ਲੋੜ ਹੁੰਦੀ ਹੈ ਇਸ ਲਈ ਅਸੀਂ ਅਸੀਂ ਕਹਿ ਸਕਦੇ ਹਾਂ ਕਿ ਬਾਹਰਲੀ ਗਤੀਵਿਧੀਆਂ ਲਈ ਸਾਹਸ ਦੀ ਲੋੜ ਹੁੰਦੀ ਹੈ